ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੇਰੇ ਕੋਲ ਪੁਰਾਣੀ ਇੱਕ ਫੋਟੋਆਂ ਦੀ ਹਾਰਡ ਕਾਪੀ ਨਾਈਨਟੀਨ ਨਾਈਨਟੀ ਸੈਵਨ ਮੇ ਅਤੇ ਦੋ ਹਜ਼ਾਰ ਤੱਕ ਦੀ ਹਾਰਡ ਕਾਪੀਆਂ ਪੁਰਾਣੀਆਂ ਪਈਆਂ ਨੇ ਹਾਂਜੀ ਪੁਰਾਣੀਆਂ ਫੋਟੋਆਂ ਅਤੇ ਕਲਿੱਕ ਕੀਤੀਆਂ ਹਾਂਜੀ ਪਈਆਂ ਹੋਈਆਂ ਨੇ ਬਹੁਤ ਪਈਆਂ ਹੋਈਆਂ ਨੇ ਪੁਰਾਣੀਆਂ ਅਤੇ ਨਵੀਆਂ ਡਿਜੀਟਲ ਫੋਟੋਆਂ ਅਤੇ ਬਹੁਤ ਹੀ ਜ਼ਿਆਦਾ ਡਿਫਰੈਂਟ ਆ ਜੇ ਪੁਰਾਣੀਆਂ ਫੋਟੋਆਂ ਨੂੰ ਆਪਾਂ ਦੇਖੀਏ ਤਾਂ ਪੁਰਾਣੀਆਂ ਫੋਟੋਆਂ ਦੀਆਂ ਆਪਣੀਆਂ ਹੀ ਕੁਝ ਯਾਦਾਂ ਨੇ ਹਾਂਜੀ ਮੈਂ ਆਪਣੀ ਮੰਮੀ ਦੀ ਵਿਆਹ ਦੀ ਐਲਬਮ ਦੇਖ ਰਿਹਾ ਸੀਗਾ ਅਤੇ ਪੁਰਾਣੇ ਜਿਹੜੇ ਲੋਕ ਸੀ ਉਹਨਾਂ ਦੇ ਮਤਲਬ ਰਹਿਣ ਸਹਿਣ ਦਾ ਕੱਪੜੇ ਪਾਉਣ ਦਾ ਢੰਗ ਬਹੁਤ ਹੀ ਜ਼ਿਆਦਾ ਫ਼ਰਕ ਹੁੰਦਾ ਸੀਗਾ ਅਤੇ ਅੱਜ ਕਲ੍ਹ ਜੇ ਆਪਾਂ ਨਵੀਆਂ ਫੋਟੋਆਂ ਦੀ ਗੱਲ ਕਰੀਏ ਤਾਂ ਉਹ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਜਿਹੜੇ ਅੱਜ ਕੱਲ੍ਹ ਫੋਟੋਆਂ ਖਿੱਚਦੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸਾਫ਼ ਵਧੀਆ ਫੋਟੋਆਂ ਆਉਂਦੀਆਂ ਪਰ ਪੁਰਾਣੇ ਜਿਹੜੇ ਤੌਰ ਤਰੀਕੇ ਆ ਉਸ ਤਰ੍ਹਾਂ ਦਾ ਉਸ ਵਿੱਚ ਰ ਮੈਨੂੰ ਦਿਖਦਾ ਨਹੀਂ ਹੈਗਾ ਕਿ ਓ ਉਹ ਉਹ ਮਤਲਵ ਗੱਲਬਾਤ ਗੱਲਬਾਤ ਹੋਊਗੀ ਪੁਰਾਣੀਆਂ ਫੋਟੋਆਂ ਪਰਾਣੀਆਂ ਸੀਗੀਆਂ ਅਤੇ ਉਹਦਾ ਅਸੀਂ ਬਹੁਤ ਕੁਝ ਪੁਰਾਣੀਆਂ ਯਾਦਾਂ ਨੇ ਨਵੀਆਂ ਫੋਟੋਆਂ ਵੀ ਠੀਕ ਨੇ ਆਪਣੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਜਨਰੇਸ਼ਨ ਨਵੀਂ ਆ ਰਹੀ ਆ ਨਵਾਂ ਯੁੱਗ ਆ ਬਹੁਤ ਕੁਝ ਡਿਫਰੈਂਸ ਫ਼ਰਕ ਆ ਪਰ ਨਹੀਂ ਜੇ ਆਪਾਂ ਪੁਰਾਣਾ ਟਾਈਮ ਵੇਖੀਏ ਤਾਂ ਪੁਰਾਣੇ ਟਾਈਮ ਵਰਗੀ ਕੋਈ ਰੀਸ ਨਹੀਂ ਹੈਗੀ ਮੇਰੇ ਹਿਸਾਬ ਨਾਲ ਪੁਰਾਣਾ ਟਾਈਮ ਬੈਟਰ ਸੀਗਾ ਬਹੁਤ ਜ਼ਿਆਦਾ ਬੈਟਰ ਸੀਗਾ ਵਧੀਆ ਸੀਗਾ ਜਿਹਨੂੰ ਕਹਿ ਸਕਦੇ ਹਾਂ ਆਪਾਂ ਹਾਂਜੀ